ਮੈਂ ਆਪਣੇ ਸਿਲਾਈ ਬੁਣਾਈ ਪ੍ਰੋਜੈਕਟਾਂ ਦੀ ਆਮ ਘਰ ਚੋਣ ਕਰਨ ਵਾਸਤੇ ਆਮ ਤੌਰ 'ਤੇ ਦੁਕਾਨ 'ਤੇ ਜਾ ਕੇ ਹੀ ਚੋਣ ਕਰਦੀ ਹਾਂ ਉੱਥੇ ਜਾ ਕੇ ਮੈਂ ਦੁਕਾਨ ਦੇ ਉੱਤੇ ਦੁਕ ਸ਼ੋਪ ਕੀਪਰ ਦੇ ਕੋਲੋਂ ਰੰਗਾਂ ਦਾ ਪਲੈਟਰ ਮੰਗਦੀ ਹਾਂ ਜਿਹਦੇ ਵਿੱਚ ਮੈਂ ਰੰਗਾਂ ਨੂੰ ਆਪਸ ਵਿੱਚ ਮੈਚ ਕਰਕੇ ਆਪਣੇ ਕਲਰਾਂ ਦੀ ਚੋਣ ਕਰਦੀ ਹਾਂ ਰੰਗਾਂ ਦੀ ਚੋਣ ਕਰਨ ਲਈ ਮੇਰੇ ਕੋਲ ਇਹੀ ਸੁਝਾਵ ਹੈ ਕਿ ਤੁਹਾਨੂੰ ਇੱਕ ਰੰਗ ਨੂੰ ਦੂਜੇ ਰੰਗ ਨਾਲ ਥੋੜ੍ਹਾ ਜਿਹਾ ਟੱਚ ਕਰਕੇ ਦੇਖਣਾ ਚਾਹੀਦਾ ਹੈ ਕਿ ਜਿਸ ਕੱਪੜੇ 'ਤੇ ਜਿਸ ਪੇਪਰ 'ਤੇ ਅਸੀਂ ਲਗਾ ਰਹੇ ਹਾਂ ਕੀ ਉਹ ਉਸ ਨਾਲ ਚੱਲ ਰਿਹਾ ਹੈ ਉਹਦੇ ਉੱਤੇ ਉੱਠ ਰਿਹਾ ਹੈ ਇਸ ਕਰਕੇ ਇਹਨਾਂ ਚੋਣਾਂ ਇਸਦੀ ਚੋਣ ਇਸ ਤਰ੍ਹਾਂ ਕੀਤੀ ਜਾ ਸਕਦੀ ਹੈ ਧੰਨਵਾਦ ਮੇਰੇ ਮਨਪਸੰਦ ਰੰਗ ਹਨ ਰੈਡ ਯੈਲੋ ਗਰੀਨ